ਹਾਂਜੀ ਹੈਲੋ ਮੈਮ ਨਮਸਕਾਰ ਜੀ ਹਾਂਜੀ ਤੁਸੀਂ ਹਾਊਸ ਇੰਟੀਰੀਅਰ ਹੋ ਹਾਂਜੀ ਮੈਂ ਨਾ ਆਪਣੇ ਘਰ ਨੂੰ ਰੈਨੋਵੇਟ ਕਰਵਾਉਣਾ ਹੈ ਮੇਰੇ ਘਰ ਵਿੱਚ ਚਾਰ ਕਮਰੇ ਹੈਗੇ ਨੇ ਇੱਕ ਮੇਰਾ ਆਪਣਾ ਹਾਂ ਉਸਨੂੰ ਤਾਂ ਆਪਾਂ ਮਤਲਬ ਕਿ ਜਿਹੜਾ ਮਰਜੀ ਕਲਰ ਤੁਸੀਂ ਆਪੇ ਡਿਜ਼ਾਇਨ ਦੱਸ ਦਿਓ ਕਿਸ ਤਰ੍ਹਾਂ ਦੇ ਬਣਵਾਵਾਂ ਹਾਂਜੀ ਬ੍ਰਾਊਨਿਸ਼ ਵਿੱਚ ਮੈਨੂੰ ਦੱਸ ਦਿਓ ਕੀ ਬ੍ਰਾਊਨਿਸ਼ ਵਿੱਚ ਵਧੀਆ ਲੱਗੇਗਾ ਨਾ ਉਸ ਇੰਟੀਰੀਅਰ 'ਚ ਸਾਡਾ ਰੂਮ ਤਾਂ

ਹਾਂਜੀ ਸ਼ੀਟਸ ਹੀ ਲਗਵਾਉਣੀਆਂ ਨੇ ਸ਼ੀਟਸ ਹੀ ਲਗਵਾਉਣੀਆਂ ਪੂਰੇ ਘਰ ਵਿੱਚ ਇੱਕ ਮੇਰੀ ਮਦਰ ਇਨ ਲੌ ਅਤੇ ਫਾਦਰ ਇਨ ਲੌ ਦਾ ਰੂਮ ਹੈ ਉਨ੍ਹਾਂ ਦੇ ਤੁਸੀਂ ਸ਼ੀਟਸ ਹੀ ਲਗਵਾ ਸਾਰੇ ਹੀ ਲਗਵਾ ਦੇਣਾ ਸਟਾਟਿੰਗ ਤੋਂ ਲੈ ਕੇ ਉੱਪਰ ਤੱਕ ਅਪਰ ਤੱਕ ਇੱਕ ਮੇਰੇ ਬੇਟਾ ਹੈਗਾ ਉਹ ਦੇ ਰੂਮ ਨੂੰ ਤੁਸੀਂ ਕਰਨਾ ਰੈਨੋਵੇਟ ਉਹ ਦਾ ਤਾਂ ਬਲਿਊ ਕਲਰ 'ਚ ਕਰਵਾ ਦੇਣਾ ਅਤੇ ਹਾਂਜੀ ਬੇਬੀਜ਼ ਦੇ ਅਕੋਡਿੰਗ ਤੁਸੀਂ ਸ਼ੀਟਸ ਅਤੇ ਉਹੋ ਜਿਹਾ ਹੀ ਡਿਜ਼ਾਇਨ ਲਗਵਾ ਦੇਣਾ ਨਾ

ਬੋਆਇਸ 'ਚ ਹਾਂਜੀ ਹਾਂਜੀ ਹਾਂਜੀ ਅਤੇ ਇੱਕ ਤੁਸੀਂ ਮੰਦਰ ਨੂੰ ਕਰਵਾਉਣਾ ਮੰਦਰ ਦਾ ਵੀ ਤੁਸੀਂ ਕਰਵਾ ਦੇਣਾ ਅਤੇ ਉਹ ਦੇ ਤੁਸੀਂ ਦੇਖ ਲੈਣਾ ਕਲਰਫੁੱਲ ਜਿਵੇਂ ਰੈੱਡ ਯੈਲੋ ਓਰੇਂਜ ਜਿਸ ਟਾਈਪ ਦਾ ਵੀ ਤੁਹਾਨੂੰ ਲੱਗੇ ਉਸ ਤਰ੍ਹਾਂ ਦੇ ਡਿਜ਼ਾਇਨ ਲੈ ਆਉਣਾ ਅਤੇ ਤੁਸੀਂ ਮੇਰੇ ਕੋਲ ਆ ਜਾਣਾ ਜਿਵੇਂ ਤੁਹਾਨੂੰ ਠੀਕ ਲੱਗੇਗਾ ਉਸ ਤਰ੍ਹਾਂ ਦੇ ਫਿਰ ਮੈਂ ਡਿਜ਼ਾਇਨ ਸਿਲੈਕਟ ਕਰਕੇ ਅਤੇ ਆਪਾਂ ਕਰ ਲਵਾਂਗੇ ਤੁਸੀਂ ਦੋ ਕੁ ਦਿਨ ਤੱਕ ਆ ਜਾਇਓ ਸੈਟਡੇ ਸੰਡੇ ਓਫ ਹੁੰਦਾ ਕੱਲ੍ਹ ਤਾਂ ਮੈਨੂੰ ਨਹੀਂ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਬਲਿਊ ਕਲਰ ਵਿੱਚ ਲੈ ਆਉਣਾ ਫਿਰ ਆਪਾਂ ਕਰ ਲਵਾਂਗੇ ਜਿਹੜੇ ਤੁਹਾਡੇ ਕੋਲ ਡਿਜ਼ਾਇਨ ਪਏ ਹੋਏ ਬਲਿਊ ਕਲਰ 'ਚ ਉਹ ਵਾਲੇ ਆਪਾਂ ਕਰ ਲਵਾਂਗੇ ਬੱਚਿਆਂ ਵਾਲੇ 'ਚ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਥੈਂਕਿਊ ਧੰਨਵਾਦ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ